ਹੈਲੋ ਹਾਂਜੀ ਮੈਮ

ਹਾਂਜੀ ਮੈਮ ਹਾਂਜੀ

ਹਾਂਜੀ ਹਾਂਜੀ ਅਸੀਂ ਟਰੈਵਲਿੰਗ ਏਜੰਸੀ ਅਸੀਂ ਪ੍ਰੋਵਾਈਡ ਕਰਦੇ ਹਾਂਜੀ ਹਾਂਜੀ ਹਾਂਜੀ ਸ਼ੋਰ ਹਾਂਜੀ ਹਾਂਜੀ ਸ਼ੋਰ ਮੈਮ ਅਸੀਂ ਦੱਸ ਦਿੰਦੇ ਇੱਥੇ ਅੰਮ੍ਰਿਤਸਰ ਵਿੱਚ ਚਾਰ ਪੰਜ ਚੀਜ਼ਾਂ ਹੈ ਜੋ ਤੁਸੀਂ ਘੁੰਮ ਸਕਦੇ ਹੋ ਜਿੱਦਾਂ ਗੋਲਡਨ ਟੈਂਪਲ ਹੈ ਦੁਰਗਿਆਨਾ ਮੰਦਿਰ ਹੈ ਦੋ ਮੋਲਸ ਹੈ ਐਲਫਾ ਮੋਲ ਹੈ ਟ੍ਰਿਲੀਅਮ ਮੋਲ ਹੈ ਅਤੇ ਨਾਲ ਮਤਲਬ ਖਾਣ ਪੀਣ ਨੂੰ ਵੀ ਤੁਹਾਨੂੰ ਪਤਾ ਹੀ ਹੈ ਅੰਮ੍ਰਿਤਸਰ ਪੰਜਾਬ ਦੀ ਧਰਤੀ 'ਤੇ ਹੈ ਇਹ ਤਾਂ ਬੜਾ ਕੁਛ ਖਾਣ ਪੀਣ ਨੂੰ ਵੀ ਤੁਹਾਨੂੰ ਵਧੀਆ ਮਿਲੇਗਾ ਅਤੇ ਨੀਅਰ ਬਾਏ ਇੱਥੇ ਨਾ ਵਾਹਗਾ ਬੋਡਰ ਵੀ ਹੈ ਅੱਧੇ ਪੌਣੇ ਘੰਟੇ ਦੇ ਰਸਤੇ 'ਚ ਤਾਂ ਤੁਸੀਂ ਜੇ ਤੁਸੀਂ ਸਾਰੀਆਂ ਚੀਜ਼ਾਂ ਹੀ ਇੰਕਲੂਡ ਕਰਨਾ ਚਾਹੁੰਦੇ ਹੋ ਤਾਂ ਤਿੰਨ ਚਾਰ ਦਿਨ ਦਾ ਟਰਿੱਪ ਤੁਹਾਡਾ ਵਧੀਆ ਬਣ ਜਾਏਗਾ ਇਹ ਅਤੇ ਖਾ ਜੇ ਅ ਤੁਸੀਂ ਗੋਲਡਨ ਟੈਂਪਲ ਤੁਸੀਂ ਉਹ ਸੀਕੁਐਂਸ ਵਾਈਜ਼ ਮੈਂ ਤੁਹਾਨੂੰ ਲਿਖ ਕੇ ਜਿੱਦਾਂ ਵੀ ਭੇਜ ਦੇਵਾਂਗੀ ਕਿ ਪਹਿਲਾਂ ਆਪਾਂ ਗੋਲਡਨ ਟੈਂਪਲ ਵਿਜ਼ਿਟ ਕਰਾਂਗੇ ਅਤੇ ਆਉਂਦੇ ਹੋਏ ਇੱਕ ਮੋਲ ਦੇਖ ਲਵਾਂਗੇ ਨੈਕਸਟ ਡੇ ਆਪਾਂ ਨੈਕਸਟ ਮੋਲ ਰੱਖ ਸਕਦੇ ਅਤੇ ਦੁਰਗਿਆਨਾ ਮੰਦਿਰ ਰੱਖ ਸਕਦੇ ਹਾਂ ਥਰਡ ਡੇ ਤੁਹਾਡਾ ਵਾਹਗਾ ਬੋਡਰ ਦਾ ਰੱਖ ਸਕਦੇ ਹਾਂ ਨਾ ਹਾਂਜੀ ਹਾਂਜੀ ਹਾਂਜੀ ਮੈਮ ਤੁਸੀਂ ਆਪਣਾ ਬਜਟ ਹਾਂਜੀ ਹਾਂਜੀ

ਨਹੀਂ ਨਹੀਂ ਮੈਮ ਅਸੀਂ ਥੋੜਾ ਤੁਹਾਨੂੰ ਡਿਸਕਾਉਟ ਤੁਹਾਨੂੰ ਡਿਸਕਾਊਂਟਡ ਪ੍ਰਾਈਸਸ 'ਤੇ ਠੀਕ ਹੈ ਅਸੀਂ ਡਿਸਕਾਊਂਟਡ ਪ੍ਰਾਈਸ 'ਤੇ ਹੋਟਲਸ ਵੀ ਵਗੈਰਾ ਦਿੰਦੇ ਹਾਂ ਸਾਡੀ ਅ ਸਾਨੂੰ ਪਤਾ ਹੈ ਕੁਛ ਆਈਡੀਆ ਹੈ ਹੋਟਲਸ ਦਾ ਜਿੱਦਾਂ ਤੁਸੀਂ ਔਨਲਾਈਨ ਸਰਚ ਕਰੋਗੇ ਤਾਂ ਮੈਮ ਉਹ ਤੁਹਾਨੂੰ ਜ਼ਿਆਦਾ ਹੀ ਦਿਖਾਉਣਗੇ ਪ੍ਰਾਈਜ਼ਿਜ਼ ਨਾ ਅਤੇ ਅਸੀਂ ਇੱਥੋਂ ਦੇ ਰਹਿਣ ਵਾਲੇ ਐਂ ਰੋਜ਼ ਡੀਲ ਕਰਦੇ ਇਹਨਾਂ ਚੀਜ਼ਾਂ ਨਾਲ ਤਾਂ ਸਾਨੂੰ ਸਭ ਪਤਾ ਹੈ ਤਾਂ ਅਸੀਂ ਉਹ ਆਪਣੇ ਆਪ ਦੇਖ ਲਵਾਂਗੇ 'ਤੇ ਤੁਸੀਂ ਮੈਨੂੰ ਥੋੜ੍ਹਾ ਆਪਣਾ ਬਜਟ ਦਾ ਆਈਡੀਆ ਜ਼ਰੂਰ ਦੇ ਦਿਓ ਕਿ ਕਿੰਨਾ ਕੁ ਤੁਸੀਂ ਛ ਪਲੈਨ ਕਰ ਰਹੇ ਹੋ ਤਾਂ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਦੇਵਾਂਗੇ ਕਿ ਕਿਹੜਾ ਹੋਟਲ ਕਿ ਤੁਹਾਡੇ ਲਈ ਅੱਛਾ ਹੈ ਅੱਛਾ ਜੀ ਠੀਕ ਹੈ ਠੀਕ ਹੈ ਠੀਕ

ਹਾਂਜੀ ਹਾਂਜੀ ਠੀਕ ਹੈ ਮੈਮ ਠੀਕ ਹੈ ਠੀਕ ਹੈ ਮੈਮ ਠੀਕ ਹੈ ਜੀ ਠੀਕ ਹੈ ਮੈਮ ਤਾਂ ਤੁਹਾਡਾ ਇਹ ਟੈਕਸ ਹਾਂ ਠੀਕ ਹੈ ਮੈਮ ਤੁਹਾਡਾ ਟੈਕਸੀ ਦਾ ਪ੍ਰਾਈਜ਼ ਫਿਰ ਅਸੀਂ ਓਵੇਂ ਹੀ ਘੱਟ ਕਰ ਦੇਵਾਂਗੇ ਅਤੇ ਤੁਹਾਡੇ ਕੋਲ ਆਪਣੀਆਂ ਕਾਰਾਂ ਹੋਣਗੀਆਂ ਤਾਂ ਅਸੀਂ ਉਸ ਹਿਸਾਬ ਨਾਲ ਕਰ ਲਵਾਂਗੇ ਠੀਕ ਹੈ ਮੈਮ ਠੀਕ ਹੈ ਮੈਮ ਹਾਂਜੀ ਮੈਂ ਤੁਹਾਨੂੰ ਆਈਟਨਰੀ ਬਣਾ ਕੇ ਭੇਜਦੀ ਹਾਂ ਤਾਂ ਤੁਸੀਂ ਚੈੱਕ ਕਰ ਲਿਓ ਓਕੇ ਮੈਮ